ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਮਿਊਨਸੀਪਲ ਕਮੇਟੀ ਤੋਂ ਬੋਲ ਰਹੇ ਹੋ ਹਾਂਜੀ ਅਸੀਂ ਨਾ ਇਸ ਸ਼ਹਿਰ 'ਚ ਨਵੇਂ ਆਏ ਸੀਗੇ ਅਤੇ ਮੇਰਾ ਅਡਰੈਸ ਹੈਗਾ ਜੀ ਗੁਰੂ ਤੇਗ ਬਹਾਦਰ ਨਗਰ ਗਲੀ ਨੰਬਰ ਪੰਜ ਹਾਊਸ ਨੰਬਰ ਹੈਗਾ ਬੀ ਸਿਕਸ ਟਵੈਲਵ ਫਾਈਵ ਅਤੇ ਅਸੀਂ ਹੰਡਾਏ ਰੋਡ 'ਤੇ ਰਹਿੰਦੇ ਆ ਜੀ ਅਤੇ ਸਾਨੂੰ ਥੋੜ੍ਹੀ ਜਿਹੀ ਕੂੜੇ ਦੀ ਬੜੀ ਦਿੱਕਤ ਆ ਰਹੀ ਆ ਇੱਕ ਤਾਂ ਇੱਥੇ ਏਰੀਆ ਨਵਾਂ ਸਾਨੂੰ ਪਤਾ ਨਹੀਂ ਵੀ ਕੂੜੇ ਵਾਲੇ ਕਿਸ ਟਾਈਮ ਆਉਂਦੇ ਆ ਕਿਸ ਟਾਈਮ ਨਹੀਂ ਕੂੜਾ ਕਾਫੀ ਇਕੱਠਾ ਹੋ ਜਾਂਦਾ ਫਿਰ ਸਾਨੂੰ ਗੱਡੀ 'ਤੇ ਜਾ ਕੇ ਬਾਹਰ ਸਿੱਟ ਕੇ ਆਉਣਾ ਪੈਂਦਾ ਗਾ ਕਿਉਂਕਿ ਉਹ ਸਮੈਲ ਆਉਂਦੀ ਆ ਅਤੇ ਇਸ ਤੋਂ ਬਿਮਾਰੀ ਲੱਗਣ ਦਾ ਡਰ ਰਹਿੰਦਾ ਤੁਸੀਂ ਸਾਨੂੰ ਪਲੀਜ਼ ਦੱਸ ਦਿਓ ਵੀ ਕੂੜੇ ਵਾਲੇ ਕਿੰਨੇ ਟਾਈਮ 'ਤੇ ਆਉਂਦੇ ਆ ਕਿਸ ਟਾਈਮ ਆਉਂਦੇ ਆ ਅਸੀਂ ਤਾਂ ਕੂੜਾ ਵੀ ਅਲੱਗ ਅਲੱਗ ਰੱਖਦੇ ਹਾਂ ਗਿੱਲਾ ਕੂੜਾ ਅਲੱਗ ਰੱਖਦੇ ਆ ਸੁੱਕਾ ਕੂੜਾ ਅਲੱਗ ਰੱਖਦੇ ਹਾਂ ਬਾਕੀ ਗੱਲ ਰਹੀ ਸਾਫ ਸਫਾਈ ਦੀ ਅਸੀਂ ਉਹ ਵੀ ਪੂਰੀ ਰੱਖਦੇ ਹਾਂ ਧਿਆਨ ਵੀ ਕੋਈ ਕਚਰਾ ਇਕੱਠਾ ਨਾ ਜਾਵੇ ਤਾਂ ਕਿ ਪਸ਼ੂ ਨੂੰ ਪਾਇਆ ਜਾ ਸਕੇ ਗਿੱਲਾ ਕੂੜਾ ਅਤੇ ਜਿਹੜਾ ਗਿੱਲਾ ਕੂੜਾ ਉਹ ਅਸੀਂ ਅਲੱਗ ਪਲਾਸਟਿਕ ਦੇ ਲਿਫਾਫੇ 'ਚ ਵੀ ਨਹੀਂ ਪਾਉਂਦੇ ਅਸੀਂ ਸਿਰਫ ਐਵੇਂ ਹੀ ਡਸਟਬੀਨ 'ਚ ਰੱਖਦੇ ਹਾਂ ਤਾਂ ਕਿ ਡਸਟਬੀਨ 'ਚੋਂ ਐਵੇਂ ਹੀ ਪਾਇਆ ਜਾਵੇ ਅਤੇ ਨਾਲੇ ਜਿਹੜੇ ਕਚਰੇ ਵਾਲੇ ਆਉਣਗੇ ਵੀ ਉਹਨਾਂ ਨੂੰ ਵੀ ਚੱਕਣਾ ਸੌਖਾ ਹੋ ਜੇ ਉਹ ਸਾਨੂੰ ਉਹਨਾਂ ਦੱਸਿਆ ਜਾਵੇ ਵੀ ਕਿਹੜੇ ਕਿਹੜੇ ਦਿਨ ਆਉਂਦੇ ਅਤੇ ਕਿਸ ਟਾਈਮ ਆਉਂਦੇ ਆ ਜੇ ਕਿਵੇਂ ਸੋਮਵਾਰ ਆਉਂਦੇ ਆ ਕਿ ਮੰਗਲਵਾਰ ਸਾਨੂੰ ਇਹ ਵੀ ਦੱਸ ਦਿੱਤਾ ਜਾਵੇ ਕਿਉਂਕਿ ਸਾਨੂੰ ਪਤਾ ਹੀ ਆ ਵੀ ਸੰਡੇ ਨੂੰ ਤਾਂ ਹਰ ਇੱਕ ਥਾਂ ਛੁੱਟੀ ਹੁੰਦੀ ਆ ਤਾਂ ਉੱਥੇ ਵੀ ਹੋਵੇਗੀ ਇਸ ਲੀਏ ਇੱਕ ਕੂੜੇ ਵਾਲਿਆਂ ਨੂੰ ਸਾਡੇ ਘਰ ਦਾ ਅਡਰੈਸ ਤੁਸੀਂ ਦੱਸ ਦਿਓ ਵੀ ਇੰਨਾਂ ਇਹਨਾਂ ਦਾ ਘਰ ਦਾ ਐਡਰੈਸ ਹੈਗਾ ਗੁਰੂ ਤੇਗ ਬਹਾਦਰ ਨਗਰ ਹੈਗਾ ਅਤੇ ਮੇਰਾ ਹਾਊਸ ਨੰਬਰ ਤੁਹਾਨੂੰ ਮੈਂ ਦੱਸ ਹੀ ਦਿੱਤਾ ਉਹ ਦੱਸ ਦਿਓ ਅਤੇ ਸਾਡਾ ਹੰਡਾਏ ਰੋਡ 'ਤੇ ਘਰ ਆ ਉਹ ਦੱਸ ਦਿਓ ਤੁਸੀਂ ਪਲੀਜ਼ ਤਾਂ ਕਿ ਕੂੜੇ ਵਾਲਿਆਂ ਨੂੰ ਕੋਈ ਬਾਹਲੀ ਦਿੱਕਤ ਪਰੇਸ਼ਾਨੀ ਨਾ ਆਵੇ ਘਰ ਪੁੱਛਣ ਦੇ ਵਿੱਚ ਅਤੇ ਉਹਨਾਂ ਨੂੰ ਇਹ ਜ਼ਰੂਰ ਦੱਸ ਦਿੱਤਾ ਜਾਵੇ ਕਿ ਉਹ ਇਸ ਇਲਾਕੇ ਦੇ ਵਿੱਚ ਨਵੇਂ ਆਏ ਨੇ ਅਤੇ ਸਾਨੂੰ ਗ ਦੱਸ ਦੇਣ ਵੀ ਅਸੀਂ ਇਸ ਟਾਈਮ ਆਵਾਂਗੇ ਅਤੇ ਤੁਸੀਂ ਆਪਣਾ ਕੂੜਾ ਜੋ ਇਸ ਟਾਈਮ ਬਾਹਰ ਰੱਖ ਦਿਆ ਕਰੋ ਜਾਂ ਅਸੀਂ ਬੈੱਲ ਮਾਰ ਦਿਆ ਕਰਾਂਗੇ ਤੁਸੀਂ ਕੂੜਾ ਲੈ ਜਿਆ ਕਰਾਂਗੇ